ਹਾਂਜੀ ਜਿਵੇਂ ਤਾਰਿਆਂ ਤੋਂ ਜਿਵੇਂ ਤਾਰੇ ਸਾਨੂੰ ਬਹੁਤ ਵਧੀਆ ਲੱਗਦੇ ਜਦੋਂ ਅਸੀਂ ਪੈਨੇ ਹਾਂ ਜੇ ਸਾਨੂੰ ਸ਼ਾਮ ਨੂੰ ਜਦੋਂ ਅਸੀਂ ਬਾਹਰ ਸੋਨੇ ਹਾਂ ਤਾਂ ਸਾਨੂੰ ਬੜੀ ਤਾਰੇ ਬਹੁਤ ਵਧੀਆ ਲੱਗਦੇ ਆ ਕਈ ਤਾਰੇ ਨੀਚੇ ਡਿੱਗ ਪੈਂਦੇ ਆ ਅਸੀਂ ਉਹਨਾਂ ਨੂੰ ਕਹਿ ਦਿੰਦੇ ਆ ਜਿਵੇਂ ਤਾਰਾ ਟੁੱਟ ਗਿਆ ਸਾਡੀ ਵਿਸ਼ ਪੂਰੀ ਹੋਊਗੀ ਜਿਵੇਂ ਜਿਵੇਂ ਆਪਾਂ ਇੱਦਾਂ ਹੋਈ ਜਾਂਦਾ ਰਹਿੰਦਾ ਉਵੇਂ ਉਵੇਂ ਅਸੀਂ ਕੁਝ ਨਾ ਕੁਝ ਬੋਲੀ ਜਾਂਦੇ ਰਹਿੰਦੇ ਹਾਂ ਤਾਰਿਆਂ ਦੀ ਇਹ ਇਹ ਨਹੀਂ ਪਤਾ ਲੱਗਦਾ ਆਪਾਂ ਨੂੰ ਵੀ ਤਾਰਿਆਂ ਦੀ ਕਿੰਨੀ ਕੁ ਉਚਾਈ ਆ ਕਿੰਨੇ ਕੁ ਉੱਤੇ ਬਹਿਮੰਡ ਆ ਕਿੰਨੀ ਕੁ ਤਾਰਿਆਂ ਦੀ ਖੋਜ ਕਰੀ ਜਾਂਦੇ ਆ ਵਿਗਿਆਨੀ ਹੈ ਨਾ ਕਿੰਨੀ ਵੱਡੀ ਪ੍ਰ ਪ ਪ੍ਰਮਾ ਰੱਬ ਕਿੰਨਾ ਵੱਡਾ ਹੈਗਾ ਕਿੱਥੇ ਕਿੱਥੇ ਵਿਗਿਆਨੀ ਖੋਜਾਂ ਕਰੀ ਜਾਂਦੇ ਆ ਤਾਰਿਆਂ ਤੋਂ ਸਾਨੂੰ ਇਹੀ ਪਤਾ ਲੱਗਦਾ ਕਿ ਤਾਂ ਵਿਗਿਆਨੀ ਵੀ ਬੈਠੇ ਆ ਖੋਜਾਂ ਕਰ ਰਹੇ ਆ ਹਾਂਜੀ ਔਰ ਤਾਰੇ ਸਾਨੂੰ ਬਹੁਤ ਵਧੀਆ ਲੱਗਦੇ ਆ ਔਰ ਜਦੋਂ ਅਸੀਂ ਤਾਰੇ ਦੇਖਦੇ ਆ ਕੋਈ ਤਾਰਾ ਡਿੱਗ ਪੈਂਦਾ ਫਿਰ ਅਸੀਂ ਸਭ ਫਿਰ ਅਸੀਂ ਇਹੀ ਵੇਖਦੇ ਹੁੰਦੇ ਹਾਂ ਵੀ ਸਾਡੀ ਵਿਸ਼ ਪੂਰੀ ਹੋ ਗਈ ਤਾਰੇ ਦੀ ਅਸੀਂ ਮੁੱਠੀਆਂ ਬੰਦ ਕਰ ਲੈਂਦੇ ਹਾਂ ਤਾਰਿਆਂ ਨੂੰ ਕਹਿ ਦਿੰਦੇ ਜਿਵੇਂ ਮੁੱਠੀਆਂ ਬੰਦ ਕਰ ਲਓ ਬੱਚਿਆਂ ਨੂੰ ਵੀ ਆਪਾਂ ਕਹਿ ਦਿੰਦੇ ਆ ਮੁੱਠੀਆਂ ਬੰਦ ਕਰੋ ਆਪਣੀ ਵਿਸ਼ ਪੂਰੀ ਹੋ ਜਾਂਦੀ ਆ ਇਹਦੇ ਕਰਕੇ ਸਾਨੂੰ ਬਹੁਤ ਵਧੀਆ ਲੱਗਦੇ ਆ ਤਾਰੇ ਤਾਰੇ ਆਪਣੇ ਬ੍ਰਹਿਮ ਬ੍ਰਹਿਮੰਡ ਜਿਵੇਂ ਚੰਦ 'ਤੇ ਨਹੀਂ ਸਾਨੂੰ ਪਤਾ ਲੱਗਦਾ ਕਿੰਨੀਆਂ ਅੱਗੇ ਤੋਂ ਅੱਗੇ ਕਿੰਨੀਆਂ ਧਰਤੀਆਂ ਹੈਗੀਆਂ ਕਿੰਨੀਆਂ ਕੁ ਤਾਰੇ ਹੋਰ ਵੀ ਹੋਣਗੇ ਸਾਨੂੰ ਇਹਦੇ ਕਰਕੇ ਪਤਾ ਲੱਗਦਾ ਸਾਨੂੰ ਤਾਰੇ ਬਹੁਤ ਪਸੰਦ ਆ